ਸਤਿ ਸ਼੍ਰੀ ਅਕਾਲ ਡਾਂਸ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਡਾਂਸ ਸਾਡੇ ਮਾਨਸਿਕ ਅਤੇ ਭਾਵਨਾਤਮਕ ਸਵਸਥ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦਾ ਹੈ ਜਦੋਂ ਅਸੀਂ ਡਾਂਸ ਕਰਦੇ ਹਾਂ ਤਾਂ ਸਾਡੇ ਦਿਮਾਗ ਵਿਚ ਕੈਸਟਸੌਲ ਦਾ ਸਤਰ ਘੱਟ ਹੁੰਦਾ ਹੈ ਅਤੇ ਆਕਸਜੀਜਨ ਵਧਦੀ ਹੈ ਜਿਸ ਨਾਲ ਸਾਡਾ ਆਕਸੀਟੋਨਿਕ ਸਾਡਾ ਫੀਲ ਗੁੱਡ ਹਾਰਮੋਨ ਪੈਦਾ ਹੁੰਦਾ ਹੈ ਜਿਸ ਨਾਲ ਸਾਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਡਾਂਸ ਦੇ ਜ਼ਰੀਏ ਪੂਰੇ ਸਰੀਰ ਵਿੱਚ ਮੂਮੈਂਟਸ ਹੁੰਦੀਆਂ ਹਨ ਜਿਸ ਦੇ ਨਾਲ ਸਾਡੇ ਸਰੀਰ ਦਾ ਬਲੱਡ ਸਰਕਲ ਬਿਹਤਰ ਹੁੰਦਾ ਹੈ ਇਹ ਚਰਬੀ ਘਟਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ ਇਹ ਸਾਡੇ ਸਰੀਰ ਦੇ ਵਿੱਚ ਖੁਸ਼ੀ ਵਾਲੇ ਹਾਰਮੋਨਸ ਨੂੰ ਪੈਦਾ ਕਰਦੇ ਹਨ ਜਿਸ ਨਾਲ ਸਾਡਾ ਸਰੀਰ ਅਤੇ ਸਾਡਾ ਮਨ ਖੁਸ਼ੀ ਮਹਿਸੂਸ ਕਰਦਾ ਹੈ ਇਸ ਨਾਲ ਸਾਡੇ ਸਰੀਰ ਸਹੀ ਢੰਗ ਨਾਲ ਅਲੱਗ ਅਲੱਗ ਸਟੈਪਸ ਕੀਤੇ ਜਾਂਦੇ ਹਨ ਤਾਂ ਇਸ ਨਾਲ ਸਾਡੇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਨੂੰ ਫ਼ਾਇਦਾ ਹੁੰਦਾ ਹੈ ਡਾਂਸ ਇਕ ਫ਼ਾਇਦੇਮੰਦ ਐਕਸਰਸਾਈਜ਼ ਹੈ ਐਕਸਪਰਟ ਦੇ ਮੰਨੋ ਤਾਂ ਕਰੀਬ ਘੱਟ ਤੋਂ ਘੱਟ ਸਾਨੂੰ ਤੀਹ ਮਿੰਟ ਡਾਂਸ ਕਰਨ ਨਾਲ ਕਰਨਾ ਚਾਹੀਦਾ ਹੈ ਜਦੋਂ ਅਸੀਂ ਲਗਾਤਾਰ ਤੀਹ ਮਿੰਟ ਡਾਂਸ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਅੰਦਰ ਇੱਕ ਸੌ ਤੀਹ ਤੋਂ ਲੈ ਕੇ ਦੋ ਸੌ ਪੰਜਾਹ ਤੱਕ ਕੈਲੋਰੀ ਬਰਨ ਹੁੰਦੀ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਜੰਮੀ ਹੋਈ ਐਕਸਟਰਾ ਚਰਬੀ ਤੇਜ਼ੀ ਨਾਲ ਪਿਘਲਣ ਲੱਗਦੀ ਹੈ ਮੋਟਾਪੇ ਨਾਲ ਪਰੇਸ਼ਾਨ ਲੋਕਾਂ ਲਈ ਡਾਂਸ ਕਰਨਾ ਬਿਹਤਰ ਲਾਭਕਾਰੀ ਸਿੱਧ ਹੁੰਦਾ ਹੈ ਜਦੋਂ ਅਸੀਂ ਡਾਂਸ ਕਰਦੇ ਹਾਂ ਤਾਂ ਅਸੀਂ ਬਹੁਤ ਸਾਰੇ ਨਵੇਂ ਨਵੇਂ ਸਟੈਪਸ ਸਿੱਖਦੇ ਹਾਂ ਜਿਸ ਨਾਲ ਸਾਡੇ ਸਰੀਰ ਦੇ ਹਰ ਹਰ ਇੱਕ ਅੰਗ ਨੂੰ ਫ਼ਾਇਦਾ ਹੁੰਦਾ ਹੈ ਇਸ ਵਿੱਚ ਅਸੀਂ ਕੁਛ ਕੁ ਤੇਜ਼ ਮੂਵਮੈਂਟਸ ਅਤੇ ਕੁਛ ਕੁ ਸਲੋ ਮੂਮੈਂਟਸ ਵੀ ਕਰਦੇ ਹਾਂ ਜਿਸ ਨਾਲ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਲਚਕਦਾਰ ਬਣਦੀਆਂ ਹਨ ਇਸ ਨਾਲ ਸਾਡੇ ਸਰੀਰ ਦਾ ਬਲੱਡ ਸਰਕਲ ਵੀ ਸਹੀ ਢੰਗ ਨਾਲ ਕੰਮ ਕਰਦਾ ਹੈ ਜਦੋ ਅਸੀਂ ਡਾਂਸ ਕਰਦੇ ਹਾਂ ਤਾਂ ਸਾਡੇ ਸਰੀਰ ਅੰਦਰ ਔਸਟੈਨਿਕ ਨਾਂ ਦਾ ਹਾਰਮੋਨ ਪੈਦਾ ਹੁੰਦਾ ਹੈ ਜੋ ਸਾਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ ਇਸ ਨਾਲ ਇਸ ਨੂੰ ਅਸੀਂ ਸਾਡਾ ਫੀਲ ਗੁੱਡ ਹਾਰਮੋਨ ਦੇ ਵਜੋਂ ਵੀ ਜਾਣ ਸਕਦੇ ਹਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਡਾਂਸ ਕਰਨ ਨਾਲ ਬਨ ਇਨਸਾਨ ਅੰਦਰ ਬਹੁਤ ਸਾਰੀਆਂ ਚੰਗੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ ਅਤੇ ਉਹ ਮਿਊਜ਼ਿਕ ਦੇ ਤਾਲ ਨਾਲ ਤਾਲ ਮਿਲਾ ਕੇ ਡਾਂਸ ਕਰਦਾ ਹੈ ਡਾਂਸ ਦੇ ਜ਼ਰੀਏ ਪੂਰੇ ਸਰੀਰ ਵਿੱਚ ਮੂਵਮੈਂਟਸ ਹੋਣਗੀਆਂ ਤਾਂ ਮਾਂਸਪੇਸ਼ੀਆਂ ਨੂੰ ਫ਼ਾਇਦਾ ਹੋਵੇਗਾ ਜੋ ਲੋਕ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਉਹਨਾਂ ਲਈ ਡਾਂਸ ਇੱਕ ਬਹੁਤ ਵਧੀਆ ਤਕਨੀਕ ਹੈ ਜੋ ਉਹਨਾਂ ਦੇ ਸਰੀਰ ਵਿੱਚੋਂ ਫਾਲਤੂ ਚਰਬੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਅਤੇ ਉਹ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੇ ਸਰੀਰ ਨੂੰ ਵਧੀਆ ਕਰ ਸਕਦੇ ਹਨ ਇਸ ਲਈ ਅਸੀਂ ਲਾਸਟ ਵਿੱਚ ਇਹ ਹੀ ਕਹਿ ਸਕਦੇ ਹਾਂ ਕਿ ਡਾਂਸ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਡਾਂਸ ਕਰਦੇ ਸਮੇਂ ਜੋ ਓਸਟੈਨਿਕ ਨਾਂ ਦਾ ਹਾਰਮੋਨ ਸਾਡੇ ਸਰੀਰ ਵਿੱਚ ਪੈਦਾ ਹੁੰਦਾ ਹੈ ਉਸਨੂੰ ਅਸੀਂ ਗੁਡ ਫੀਲ ਗੁੱਡ ਹਾਰਮੋਨ ਦੇ ਨਾਂ ਨਾਲ ਵੀ ਜਾਣਦੇ ਹਾਂ ਜੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਵਾਉਂਦਾ ਹੈ ਧੰਨਵਾਦ